ਪੰਜਾਬੀ ਲੋਕ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਲਈ ਅਤੇ ਸਨਮਾਨ ਦੇਣ ਲਈ ਆਪਣੀ ਭਾਸ਼ਾ ਦੀ ਵਰਤੋਂ ਆ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਜਿਵੇਂ ਕਿ ਪੰਜਾਬੀ ਭਾਸ਼ਾ ਸਾਰਿਆਂ ਨੂੰ ਪਤਾ ਹੀ ਆ ਬਹੁਤ ਮਿੱਠੀ ਅਤੇ ਸੁਰੀਲੀ ਭਾਸ਼ਾ ਮੰਨੀ ਜਾਂਦੀ ਹੈ ਸਾਡੇ ਪੰਜਾਬੀ ਇੰਨੇ ਜਿਹੜੇ ਸਾਨੂੰ ਤਾਂ ਵੈਸੇ ਵੀ ਪੰਜਾਬੀ ਦੇ ਬਹੁਤ ਜ਼ਿਆਦਾ ਮਾਣ ਆ ਕਿਉਂਕਿ ਅਸੀਂ ਪੰਜਾਬ ਦੇ ਜੰਮੇ ਪਲੇ ਅਤੇ ਜਾਏ ਹਾਂ ਹੈ ਨਾ ਅਸੀਂ ਆਪਣਾ ਬਚਪਨ ਹਾਂ ਜਿਹੜੇ ਆਪਣੇ ਪੰਜਾਬੀ ਲੋਕਾਂ ਦੇ ਵਿੱਚ ਪੰਜਾਬੀ ਪੰਜਾਬ ਦੇ ਵਿੱਚ ਰਹਿ ਕੇ ਮਨਾਇਆ ਗਲੀਆਂ ਦੇ ਵਿੱਚ ਫਿਰੇ ਹਾਂ ਸਾਰੇ ਸਾਡੇ ਆਲੇ ਦੁਆਲੇ ਵਾਤਾਵਰਨ ਪੰਜਾਬੀ ਦੇ ਵਿੱਚ ਹੀ ਸਾਡੇ ਨਾਲ ਗੱਲਾਂ ਕਰਦੇ ਬੋਲਦੇ ਹੱਸਦੇ ਖੇਡਦੇ ਜਿਵੇਂ ਪੰਜਾਬੀਆਂ ਦਾ ਸੁਭਾਅ ਜਿਹੜਾ ਹਨਾ ਉਹ ਜਿਹੜਾ ਬਹੁਤ ਖੁੱਲ੍ਹਾ ਡੁੱਲ੍ਹਾ ਸੁਭਾਅ ਮੰਨਿਆ ਜਾਂਦਾ ਅਤੇ ਤਾਂ ਜੋ ਪੰਜਾਬੀ ਚ ਗੱਲਾਂ ਕਰਦੇ ਹਾਂ ਆਪਣੇ ਬੱਚਿਆਂ ਨੂੰ ਗਾਲਾਂ ਵੀ ਕੱਢਦੇ ਹਾਂ ਉਹ ਵੀ ਪੰਜਾਬੀ ਦੇ ਵਿੱਚ ਪਰ ਗਾਲਾਂ ਨੂੰ ਵੀ ਬੱਚੇ ਨੂੰ ਕਿਹਾ ਜਾਂਦਾ ਕਿਉਂਕਿ ਉਹ ਬੱਚੇ ਨੇ ਬਹੁਤ ਸੀਰੀਅਸ ਨਹੀਂ ਲੈ ਕੇ ਜਾਂਦੇ ਇਹਦੇ ਵਿੱਚ ਕਹਿ ਕਹਿ ਵੀ ਦਿੰਦੇ ਨੇ ਆ ਵੱਡੇ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਕਹਿੰਦੇ ਹੁੰਦੇ ਨੇ ਮਾਂ ਬਾਪ ਦੀਆਂ ਗਾਲਾਂ ਨੇ ਜਿਹੜੀਆਂ ਉਹ ਦੇਸੀ ਘਿਓ ਦੀਆਂ ਲਾਲ਼ਾਂ ਨੇ ਅਤੇ ਜਿਹੜੇ ਪੰਜਾਬੀ ਲੋਕ ਨੇ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਦੇ ਲਈ ਉਹ ਸਾਰੇ ਪਹਿਲਾਂ ਇਕੱਠੇ ਹੁੰਦੇ ਨੇ ਆਪਣੇ ਤਿਉਹਾਰ ਨੂੰ ਪੰਜਾਬੀ 'ਚ ਮਨਾਉਂਦੇ ਨੇ ਇੱਕ ਦੂਜੇ ਨਾਲ ਖੁਸ਼ੀਆਂ ਨੇ ਜਿਹੜੀਆਂ ਉਹ ਵੰਡਦੇ ਨੇ ਹੈ ਨਾ ਸਭ ਤੋਂ ਵੱਡੀ ਗੱਲ ਆ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਉਹ ਪੰਜਾਬੀ ਗੁਰਮੁਖੀ ਦੇ ਵਿੱਚ ਹੀ ਲਿਖਿਆ ਗਿਆ ਜਿਹਨੂੰ ਅਸੀਂ ਪੜ੍ਹ ਕੇ ਬਹੁਤ ਹੀ ਮਾਣ ਅਤੇ ਸਤਿਕਾਰ ਦੇ ਨਾਲ ਸ਼ਰਧਾ ਭੇਟ ਕਰਦੇ ਹਾਂ ਉਹਨੂੰ ਅਤੇ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ 'ਚ ਹੀ ਗੁਰਬਾਣੀ ਪੜ੍ਹਨ ਲਾਉਂਦੇ ਹਾਂ ਹੈ ਨਾ ਅਤੇ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਸਾਡੇ ਬੱਚੇ ਨੇ ਸਾਡੀਆਂ ਜੜ੍ਹਾਂ ਨੇ ਜਿਹੜੀਆਂ ਉਹ ਅੱਗੇ ਜਿਉਂਦੀਆਂ ਰਹਿਣਗੀਆਂ ਅਤੇ ਸਾਡੇ ਬੱਚੇ ਨੇ ਪੰਜਾਬੀ 'ਚ ਵਧਣਗੇ ਫੁੱਲਣਗੇ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨਗੇ ਬਾਹਰਲੇ ਦੇਸ਼ਾਂ ਵਿੱਚ ਵੀ ਪੰਜਾਬੀ ਨੂੰ ਲੈ ਕੇ ਜਾਣਗੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਬੱਚੇ ਨੇ ਉਹ ਜਨਮ ਲੈਣ ਸਾਰ ਹੀ ਜਿਵੇਂ ਸਾਡੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਵੱਡੇ ਨੇ ਜਿਹੜੇ ਉਹ ਪੰਜਾਬੀ ਬੋਲਦੇ ਨੇ ਬੱਚੇ ਵੀ ਉਹਨਾਂ ਤੋਂ ਪੰਜਾਬੀ ਸਿੱਖਦੇ ਨੇ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਬੰਦ ਕਰ ਦੇਵਾਂਗੇ ਤਾਂ ਸਾਡੇ ਬੱਚੇ ਨੇ ਜਿਹੜੇ ਆਟੋਮੈਟਿਕਲੀ ਪੰਜਾਬੀ ਤੋਂ ਟੁੱਟ ਜਾਣਗੇ ਫਿਰ ਅਸੀਂ ਸਕੂਲਾਂ ਦੇ ਵਿੱਚ ਜਿਵੇਂ ਹੁਣ ਕਿ ਅੱਜ ਕੱਲ੍ਹ ਅੰਗਰੇਜ਼ੀ ਸਕੂਲਾਂ ਦੇ ਵਿੱਚ ਰੁਝਾਨ ਆ ਮਾਂ ਬਾਪ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਲਾਉਂਦੇ ਨੇ ਪਰ ਸਰਕਾਰ ਵੀ ਕੋਸ਼ਿਸ਼ ਕਰਦੀ ਆ ਵੀ ਬੱਚਿਆਂ ਨੂੰ ਪੰਜਾਬੀ ਵੱਧ ਤੋਂ ਵੱਧ ਰੋਜ਼ ਪੜ੍ਹਾਈ ਜਾਵੇ ਤਾਂ ਜੋ ਜਿਹੜੇ ਬੱਚੇ ਨੇ ਪੰਜਾਬੀ ਉਹਨਾਂ ਨੂੰ ਆਉਣੀ ਲਾਜ਼ਮੀ ਬਣ ਜਾਵੇ ਅਤੇ ਇਵੇਂ ਹੀ ਜਿਵੇਂ ਹੁਣ ਕੋਈ ਵੀ ਸਰਕਾਰੀ ਨੌਕਰੀਆਂ ਦੇ ਫਾਰਮ ਨੇ ਉਹ ਵੀ ਪੰਜਾਬੀ ਦੇ ਵਿੱਚ ਹੀ ਮਹੱਈਆ ਕਰਵਾਉਂਦੇ ਨੇ ਦਫਤਰਾਂ 'ਚ ਕੰਮ ਨੇ ਜਿਹੜੇ ਉਹ ਵੀ ਪੰਜਾਬੀ ਦੇ ਵਿੱਚ ਹੀ ਕਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਜੋ ਸਾਡੇ ਬੱਚੇ ਨੇ ਜਿਹੜੇ ਸਾਡੀਆਂ ਜੜ੍ਹਾਂ ਜਿਹੜੀਆਂ ਜੜ੍ਹਾਂ ਨੇ ਉਹ ਬਹੁਤ ਜ਼ਿਆਦਾ ਸਟਰੋਂਗ ਬਣ ਸਕਣ ਅਇਹਨੂੰ ਮਾਨ ਸਨਮਾਨ ਦੇਣ ਦੇ ਲਈ ਹੈ ਨਾ ਆਪਣੀ ਭਾਸ਼ਾ ਨੂੰ ਜਿਵੇਂ ਅਸੀਂ ਬਹੁਤ ਸਾਰੇ ਸੈਮੀਨਾਰ ਕੰਡਕਟ ਕਰਾਉਂਦੇ ਹਾਂ ਕੋਈ ਤਿਉਹਾਰ ਕਰਾਉਂਦੇ ਹਾਂ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜਦੇ ਹਾਂ ਉਹਨਾਂ ਦੇ ਲਈ ਕੋਈ ਉਹਨਾਂ ਦਾ ਟੂਰਨਾਮੈਂਟ ਵਗੈਰਾ ਲਗਾ ਲੋ ਉਹਨਾਂ ਦੇ ਕੰਪੀਟੀਸ਼ਨ ਨੇ ਜਿਹੜੇ ਉਹ ਕਰਵਾਉਂਦੇ ਹਾਂ ਤਾਂ ਜੋ ਸਾਡੇ ਬੱਚੇ ਨੇ ਜਿਹੜੇ ਵੱਧ ਤੋਂ ਵੱਧ ਉਹ ਗੁਰਬਾਣੀ ਦੇ ਨਾਲ ਪੰਜਾਬੀ ਦੇ ਨਾਲ ਜੁੜੇ ਰਹਿਣ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜ ਜਾਂਦੇ ਹਾਂ ਸਾਨੂੰ ਆਪਣੇ ਜੀਵਨ ਆ ਜਿਹੜਾ ਉਹ ਜਿਊਣ ਦੀ ਹਾਂ ਜਿਹੜੀ ਜਾਂਚ ਅਸੀਂ ਸਿੱਖ ਜਾਂਦੇ ਹਾਂ ਵੀ ਅਸੀਂ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕਠਿਨਾਈਆਂ ਨੇ ਮੁਸ਼ਕਿਲਾਂ ਨੇ ਉਹਨਾਂ ਦਾ ਅਸੀਂ ਡੱਟ ਕੇ ਮੁਕਾਬਲਾ ਕਰਦੇ ਹਾਂ ਅਤੇ ਉਹ ਤਾਂਹੀਓ ਇੱਕ ਕਰ ਸਕਦੇ ਜੇ ਸਾਡੇ ਵਿੱਚ ਉਹਨਾਂ ਕਠਿਨਾਈਆਂ ਨੂੰ ਸਹਿਣ ਕਰਨ ਦੀ ਆਦਤ ਹੋਊਗੀ ਜਾਂ ਸਹਿਣ ਕਰਨ ਦੀ ਹਿੰਮਤ ਹੋਊਗੀ ਜਿਹੜੇ ਪੰਜਾਬੀ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਹੀ ਬਹੁਤ ਜ਼ਿਆਦਾ ਹੱਲਾਸ਼ੇਰੀ ਦਿੰਦੇ ਨੇ ਅਤੇ ਇਹ ਹੱਲਾਸ਼ੇਰੀ ਹੀ ਉਹਨਾਂ ਨੂੰ ਅੱਗੇ ਵੱਧਣ ਦੀ ਹਿੰਮਤ ਹੈ ਜਿਹੜੀ ਉਹ ਬਖਸ਼ਦੀ ਹੈ ਤਾਂ ਜੋ ਬੱਚੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜਿਹੜੀ ਜਾਂਚ ਹੈ ਜੀਵਨ ਜਾਂਚ ਉਹਨੂੰ ਚੰਗੀ ਤਰ੍ਹਾਂ ਜੀ ਸਕਦੇ ਨੇ ਅਤੇ ਆਪਣੀ ਜੀਵਨ ਨੂੰ ਉੱਚੀਆਂ ਬੁਲੰਦੀਆਂ 'ਤੇ ਪਹੁੰਚਾ ਸਕਦੇ ਨੇ ਭਾਸ਼ਾ ਜਿਹੜੀ ਹੈ ਨਾ ਇਹਨੂੰ ਮਾਨ ਅਤੇ ਸਨਮਾਨ ਦੇਣ ਲਈ ਬਾਹਰਲੇ ਬੱਚੇ ਜਿਵੇਂ ਸਾਡੇ ਹੁਣ ਪੰਜਾਬ ਦੇ ਲੋਕ ਨੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਹੁਣ ਉਹ ਬਾਹਰ ਜਾ ਕੇ ਰਹਿਣਾ ਸ਼ੁਰੂ ਕਰਤਾ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਹੈ ਇੱਥੇ ਪੈਸੇ ਦੀ ਤੰਗੀ ਕਾਰਨ ਕੰਮ ਕਰਨ ਦੀ ਘਾਟ ਕਾਰਨ ਉਹ ਆਪਣਾ ਜੀਵਨ ਆ ਜਿਹੜਾ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਵੀ ਸਾਡੀ ਵਾਈਟ ਕੋਲਰ ਜੋਬ ਹੋਵੇ ਸਾਡੇ ਬੱਚਿਆਂ ਨੂੰ ਕਠਿਨਾਈਆਂ ਘੱਟ ਹੋਣ ਜਿਹੜਾ ਵਾਤਾਵਰਨ ਆ ਸ਼ੁੱਧ ਹੋਵੇ ਉੱਥੇ ਕੋਈ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਾ ਹੋਵੇ ਤਾਂ ਉਹ ਸੰਘਰਸ਼ੀ ਬਹੁਤ ਹੁੰਦੇ ਨੇ ਪੰਜਾਬੀ ਨੇ ਜਿਹੜੇ ਉਹ ਸਨਮਾਨ ਦਿੰਦੇ ਨੇ ਆਪਣੇ ਬੱਚਿਆਂ ਨੂੰ ਇਕੱਠੇ ਕਰਦੇ ਨੇ ਸਕੂਲਾਂ ਦੇ ਵਿੱਚ ਲਗਾ ਲਓ ਛੋਟੀਆਂ ਛੋਟੀਆਂ ਪਾਰਟੀਆਂ ਕਰਦੇ ਨੇ ਜਿਹਦੇ ਵਿੱਚ ਪੰਜਾਬੀ ਦੇ ਹੈ ਨਾ ਪ੍ਰੋਗਰਾਮ ਉਲੀਕੇ ਜਾਂਦੇ ਨੇ ਉਹਨਾਂ ਦੇ ਵਿੱਚ ਗੁਰਬਾਣੀ ਕਵਿਤਾ ਢਾਡੀ ਵਾਰਾਂ ਉਹ ਬੱਚਿਆਂ ਨੂੰ ਸਿਖਾਉਂਦੇ ਨੇ ਅਤੇ ਅਤੇ ਹੋਰ ਆਪਣੇ ਪੰਜਾਬ ਦੇ ਗੇਮ ਜਿਵੇਂ ਲੂਡੋ ਹੋ ਗਈ ਹੈ ਨਾ ਤੈਰਾਕੀ ਹੋ ਗਈ ਘੋੜ ਸਵਾਰੀ ਹੋ ਗਈ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਉਹ ਗੇਮਾਂ ਸਮਝਾਉਂਦੇ ਨੇ ਸਿਖਾਉਂਦੇ ਨੇ ਤਾਂ ਜੋ ਸਾਡੇ ਬੱਚੇ ਨੇ ਜਿਹੜੇ ਉਹ ਸਰੀਰਕ ਪੱਖੋਂ ਮਾਨਸਿਕ ਪੱਖੋਂ ਉਹਨਾਂ ਦਾ ਸਰੀਰਕ ਆ ਜਿਹੜਾ ਵਿਕਾਸ ਹੋ ਸਕੇ ਅਤੇ ਉਹ ਆਪਣੇ ਜੀਵਨ ਨੂੰ ਬਹੁਤ ਵਧੀਆ ਬਸਰ ਕਰ ਸਕਣ